ਹਰ ਕਿਸਾਨ ਨੂੰ ਫਸਲਾਂ ਬੀਜਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਬਹੁਤ ਸਾਰੇ ਮਿੱਤਰ ਕੀੜੇ ਵੀ ਜਿਹੜੇ ਫਸਲਾਂ ਦੀ ਵੱਧ ਪੈਦਾਵਾਰ ਵਿੱਚ ਸਹਾਈ ਹੁੰਦੇ ਹਨ ਅਤੇ ਇਸੇ ਤਰ੍ਹਾਂ ਹੋਰ ਵੀ ਹੈ ਕੀੜੇ ਜਿਹੜੇ ਜਿਹਨਾਂ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਹਨਾਂ ਕੀੜਿਆਂ ਦਾ ਜਿਹੜੇ ਮਿੱਤਰ ਕੀੜੇ ਹੈ ਉਹਨਾਂ ਨੂੰ ਬਚਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਕਿ ਝੋਨੇ ਵਗੈਰਾ ਜਾਂ ਕਣਕ ਵਗੈਰਾ ਦੀ ਨਾੜ ਨੂੰ ਅੱਗ ਨਾ ਲਈਏ ਤਾਂ ਮਿੱਤਰ ਕੀੜਿਆਂ ਦਾ ਬਚਾਅ ਹੋ ਸਕਦਾ ਹੈ ਅਤੇ ਦੂਸਰੇ ਪਾਸੇ ਜਿਹੜੇ ਦੂਜੇ ਕੀੜੇ ਹੈ ਜਿਹੜੇ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਖੇਤੀਬਾੜੀ ਮਾਹਰਾਂ ਨਾਲ ਸੰਪਰਕ ਕਰਕੇ ਜਿਹੜੇ ਜਿਹੜੇ ਵੀ ਉਹ ਸਪਰੇਅ ਵਗੈਰਾ ਦੱਸਦੇ ਹਨ ਉਹਨਾਂ ਨੂੰ ਫਸਲਾਂ ਨਾ ਫਸਲਾਂ 'ਤੇ ਸਮੇਂ ਸਮੇਂ ਸਿਰ ਛੜਕਾ ਕੀਤਾ ਜਾਂਦਾ ਹੈ ਜਿਸ ਨਾਲ ਫਸਲਾਂ ਦੇ ਝਾੜ ਵਿੱਚ ਵੀ ਵਧੇਰੇ ਅਸਰ ਪੈਂਦਾ ਹੈ ਵਾਧਾ ਹੁੰਦਾ ਹੈ